ਸੰਗੀਤ ਰਿਐਲਟੀ ਸ਼ੋਅ ਵਿੱਚ ਮੈਨੂੰ ਇੰਡੀਅਨ ਆਈਡਲ ਸ਼ੋਅ ਬੜਾ ਅੱਛਾ ਲੱਗਦਾ ਹੈ ਉਹ ਮੈਂ ਤਕਰੀਬਨ ਹਰ ਸੀਜ਼ਨ ਨੂੰ ਫੋਲੋ ਕਰਨਾ ਹਾਂ ਪਿਛਲੀ ਸੀਜ਼ਨ 'ਚ ਮੈਂ ਦੇਖਿਆ ਸੀ ਕੀ ਉੱਥੇ ਕੇ ਇੱਕ ਰਿਸ਼ੀ ਨਾਮ ਦਾ ਮੁੰਡਾ ਆਇਆ ਸੀ ਜਿਹੜਾ ਅਯੋਧਿਆ ਤੋਂ ਸੀ ਉਸ ਦੀ ਆਵਾਜ਼ ਬਹੁਤ ਹੀ ਅੱਛੀ ਤੀ ਉਸਨੇ ਪਹਿਲੀ ਹੀ ਅਡੀਸ਼ਨ ਤੇ ਆਪਣੇ ਮਤਲਬ ਕਿ ਸਾਰੇ ਜਨਤਾ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ ਅਤੇ ਉਹਦੀ ਆਵਾਜ਼ ਤਾਂ ਬਹੁਤ ਹੀ ਵਧੀਆ ਉਹਨੇ ਜਿਹਦੇ ਜਿਹਦੇ ਵੀ ਗਾਣੇ ਗਾਏ ਮੈਨੂੰ ਬਹੁਤ ਹੀ ਅੱਛੇ ਲੱਗੇ ਕਿਉਂਕਿ ਮੈਂ ਇੱਕ ਵਾਰੀ ਆਪਣਾ ਸਵੇਰੇ ਵੋਕ 'ਤੇ ਗਿਆ ਹੋਇਆ ਸੀ ਅਤੇ ਮੈਂ ਅਚਾਨਕ ਯੂਟਿਊਬ ਦੇ ਉੱਤੇ ਸਰਚ ਕੀਤਾ ਤਾਂ ਉੱਥੇ ਦੇਖਿਆ ਕਿ ਉਹਦੇ ਰਿਕੋਰਡਿੰਗਾਂ ਸ਼ੋਅ ਦੀਆਂ ਵਿੱਚ ਉਹਦੀਆਂ ਹੋਈਆਂ ਹੋਈਆਂ ਸੀ ਲੇਕਿਨ ਮੈਂ ਉਹਦੇ ਗਾਣੇ ਸੁਣੇ ਮੈਂ ਉਹਦੀ ਗਾਇਕੀ ਸੁਣੀ ਮੈਨੂੰ ਸੀ ਕਿ ਮੈਂ ਵੀ ਐਰੇ ਵਕਨ ਗਾ ਸਕਾਂ ਲੇਕਿਨ ਮੈਂ ਐਰੇ ਵਕਨ ਤਾਂ ਪੂਰਾ ਬਿਹਤਰ ਗਾ ਨਹੀਂ ਸਕਦਾ ਕਿਉਂਕਿ ਉਹ ਬਹੁਤ ਹੀ ਮੰਜਾ ਹੋਇਆ ਗਾਇਕ ਸੀ ਔਰ ਉਸ ਨੇ ਆਪਣੇ ਬਹੁਤ ਸਾਰੀਆਂ ਪਰਫੋਰਮੈਂਸ ਦਿੱਤੀਆਂ ਉਹਦੀ ਆਵਾਜ਼ ਬਹੁਤ ਹੀ ਅੱਛੀ ਸੀ ਉਸ ਲੜਕੇ ਨੇ ਪਹਿਲੇ ਦਿਨ ਤੋਂ ਹੀ ਜੱਜਾਂ ਦੇ ਉੱਤੇ ਬਹੁਤ ਅੱਛਾ ਇੰਪ੍ਰੈਸ਼ਨ ਪਾਇਆ ਸੀ ਔਰ ਉਹਦੇ ਗਾਇਕੀ ਬਹੁਤ ਹੀ ਔਰ ਵੋ ਲੜਕਾ ਵਿਨਰ ਵੀ ਬਣਿਆ ਸੀ ਰਿਸ਼ੀ ਦੇ ਗਾਣੇ ਸੁਣਨ ਵਾਲੇ ਹਨ ਉਹਨੇ ਬਹੁਤ ਅੱਛੇ ਅੱਛੇ ਗਾਣੇ ਗਾਏ ਉਹਨੇ ਕਾਫ਼ੀ ਐਸੇ ਗਾਣੇ ਉਹ ਗਾਏ ਕੇ ਇਓਂ ਲੱਗੇ ਕਿ ਜਿਸ ਜਿਸ ਗਾਇਕ ਨੇ ਪਹਿਲੇ ਗਾਇਆ ਸੀ ਕਿ ਉਹ ਹੀ ਗਾ ਰਿਹਾ ਹੈ ਔਰ ਇਹ ਹੀ ਚੀਜ਼ ਸੀ ਕਿ ਉਹਦੀ ਆਵਾਜ਼ ਬਹੁਤ ਅੱਛੀ ਸੀ ਉਹਨੇ ਆਪਣੇ ਐਡੀਸ਼ਨ ਰਾਊਂਡ ਔਰ ਆਪਣਾ ਉਹਨੇ ਇੱਕ ਵਾਰੀ ਇੱਕ ਔਤਨਾ ਦੇ ਵਿੱਚ ਇੱਕ ਰਾਊਂਡ ਹੁੰਦਾ ਉਹਦੇ ਵਿੱਚ ਗੋਲਡਨ ਮਾਈਕ ਉਹ ਵੀ ਉਹਨੇ ਬਹੁਤ ਅੱਛਾ ਕੀਤਾ ਸੀ ਉਹ ਵੀ ਉਹਨੇ ਸਭ ਤੋਂ ਵਧੀਆ ਕੀਤਾ ਸੀ ਮੈਂ ਚਾਹਵਾਂ ਕੀ ਮੈਂ ਕਿਸੇ ਵੇਲੇ ਮੈਂ ਵੀ ਸਿੰਗਰ ਬਣਾ ਲੇਕਿਨ ਮੇਰੀ ਆਵਾਜ਼ ਉਹਦੇ ਵਕਨ ਨਹੀਂ ਹੁੰਦੀ ਪਰ ਮੈਂ ਉਹਦੇ ਬਰਾਬਰ ਗਾ ਸਕਾਂ